ਮੱਧ ਪੁਰਸ਼ ਜਿਨ੍ਹਾਂ ਨੂੰ ਵਿਚੋਲਾ ਕਿਹਾ ਜਾਂਦਾ ਹੈ ਫਸਲਾਂ ਵੇਚਣ ਵਿੱਚ ਸਾਡੀ ਮਦਦ ਵੀ ਕਰਦੇ ਹਨ ਅਤੇ ਸ਼ੋਸ਼ਣ ਵੀ ਕਰਦੇ ਹਨ ਜੇਕਰ ਆਪਾਂ ਮਦਦ ਦੀ ਗੱਲ ਕਰੀਏ ਤਾਂ ਜਿਨ੍ਹਾਂ ਗਰੀਬ ਕਿਸਾਨਾਂ ਮਜ਼ਦੂਰਾਂ ਕੋਲ ਸਾਧਨ ਨਹੀਂ ਹੁੰਦੇ ਉਹਨਾਂ ਨੂੰ ਸਾਧਨ ਦਾ ਪ੍ਰਬੰਧ ਕਰਦੇ ਹਨ ਵਪਾਰੀ ਨੂੰ ਫਸਲ ਤੱਕ ਲੈ ਕੇ ਜਾਂਦੇ ਹਨ ਜਾਂ ਫਸਲ ਨੂੰ ਵਪਾਰੀ ਤੱਕ ਲੈ ਕੇ ਜਾਂਦੇ ਹਨ ਇਸ ਨਾਲ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਜੇਕਰ ਆਪਾਂ ਸ਼ੋਸ਼ਣ ਦੀ ਗੱਲ ਕਰਦੇ ਹਾਂ ਤਾਂ ਉਹ ਪਹਿਲਾਂ ਹੀ ਵਪਾਰੀ ਨਾਲ ਗੱਲਬਾਤ ਕਰਕੇ ਫਸਲ ਦਾ ਰੇਟ ਘੱਟ ਲਗਵਾਉਂਦੇ ਹਨ ਜਾਂ ਉਸ ਵਿੱਚ ਆਪਣਾ ਕਮਿਸ਼ਨ ਰੱਖਦੇ ਹਨ ਕਿ ਸਾਡਾ ਇੰਨਾਂ ਕਮਿਸ਼ਨ ਹੋਵੇਗਾ ਇਸ ਨਾਲ ਕਿਸਾਨ ਗਰੀਬ ਮਜ਼ਦੂਰ ਦਾ ਸੋਸ਼ਣ ਹੁੰਦਾ ਹੈ ਇਸ ਦੇ ਨਾਲ ਹੀ ਜੋ ਜਾਗਰੂਕ ਕਿਸਾਨ ਹੁੰਦੇ ਹਨ ਉਹ ਖ਼ੁਦ ਆਪਣੀਆਂ ਫਸਲਾਂ ਵੇਚਦੇ ਹਨ ਉਹ ਮੱਧ ਪੁਰਸ਼ਾਂ ਨੂੰ ਵਿਚੋਲੇ ਨੂੰ ਆਪਣੇ ਅਤੇ ਵਪਾਰੀ ਦੇ ਵਿੱਚ ਨਹੀਂ ਪਾਉਂਦੇ ਜਿਸ ਨਾਲ ਕਿ ਉਹਨਾਂ ਨੂੰ ਫਸਲ ਦਾ ਚੰਗਾ ਰੇਟ ਮਿਲਦਾ ਹੈ ਅਤੇ ਆਮਦਨ ਵਿੱਚ ਵਾਧਾ ਹੁੰਦਾ ਹੈ